ਆਮ ਤੌਰ 'ਤੇ ਕਾਗਜ਼ 'ਤੇ ਪੈੱਨ ਨਾਲ਼ ਲਿਖਣ ਦਾ ਵਿਕਲਪ ਸਭ ਤੋਂ ਆਮ ਹੈ ਇਹ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਾਗਜ਼ 'ਤੇ ਪੈੱਨ ਨਾਲ਼ ਲਿਖਣਾ ਇੱਕ ਸਕੂਲ ਵਿੱਚ ਸਭ ਤੋਂ ਪਹਿਲਾਂ ਇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੱਜ ਕੱਲ੍ਹ ਇਹ ਸਮੇਂ ਅਨੁਸਾਰ ਇਹ ਵਿਕਲਪ ਬਦਲ ਗਿਆ ਹੈ ਇਹਨਾਂ ਦੀ ਥਾਂ ਅੱਜ ਕੱਲ੍ਹ ਮ ਮੋਬਾਇਲ ਅਤੇ ਲੈਪਟੋਪ ਨੇ ਲੈ ਲਈ ਹੈ ਆਮ ਇਨਸਾਨ ਕੋਲ ਹਰ ਹਰ ਵੇਲੇ ਕਾਗਜ਼ ਜਾਂ ਕਲਮ ਨਹੀਂ ਹੁੰਦਾ ਪਰ ਮੋਬਾਇਲ ਹਰ ਇੱਕ ਦੀ ਜੇਬ ਵਿੱਚ ਅੱਜ ਕੱਲ੍ਹ ਆਮ ਹੋ ਗਿਆ ਹੈ ਜਿਸ ਕਰਕੇ ਮੋਬਾਇਲ ਜਾਂ ਲੈਪਟੋਪ 'ਚ ਟਾਈਪ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਵਿੱਦਿਅਕ ਸੰਸਥਾਵਾਂ ਸਰਕਾਰੀ ਅਦਾਰਿਆਂ ਵਿੱਚ ਵੀ ਇਹਨਾਂ ਦਾ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਡਾਕ ਰਾਹੀਂ ਅਗਰ ਅਸੀਂ ਕਾਗਜ਼ 'ਤੇ ਕੁਛ ਲਿਖ ਕੇ ਕਿਸੇ ਨੂੰ ਭੇਜਣਾ ਤਾਂ ਇਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਪਰ ਆਧੁਨਿਕ ਵਿੱਦਿਆ ਅਨੁਸਾਰ ਮੋਬਾਇਲ ਜਾਂ ਲੈਪਟੋਪ ਰਾਹੀਂ ਨੈੱਟਵਰਕ ਨਾਲ਼ ਕੋਈ ਵੀ ਚੀ ਕੋਈ ਵੀ ਜਾਣਕਾਰੀ ਅਸੀਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ ਇਸ ਕਰਕੇ ਆਧੁਨਿਕ ਸਮੇਂ ਵਿੱਚ ਲੈਪਟੋਪ ਅਤੇ ਮੋਬਾਇਲ ਨੇ ਕਾਗਜ਼ ਦੀ ਥਾਂ ਲੈ ਲਈ ਹੈ ਅਤੇ ਇਹ ਆਧੁਨਿਕ ਜੀਵਨ ਦਾ ਇੱਕ ਹਿੱਸਾ ਬਣ ਚੁੱਕਿਆ ਹੈ